ਪੰਜਾਬ ਵਿੱਚ ਸਾਡੇ ਸ਼ਹਿਰੀ ਅਤੇ ਪੇਂਡੂ ਸਾਰੇ ਖੇਤਰ ਦੇ ਵਿੱਚ ਵੱਖਰੇ ਵੱਖਰੇ ਲੋਕ ਵੱਸਦੇ ਹਨ ਅਤੇ ਇੱਥੇ ਵੱਖਰੇ ਵੱਖਰੇ ਵਸਣ ਵਾਲੇ ਲੋਕਾਂ ਦੇ ਵਿੱਚ ਉਹਨਾਂ ਦੇ ਵਿੱਚ ਸੱਭਿਆਚਾਰਕ ਅੰਤਰ ਵੀ ਰਹਿ ਗਿਆ ਹੈ ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਜਿਹੜਾ ਪੰਜਾਬ ਹੈ ਸਾਡਾ ਪ ਪ੍ਰਵੇਸ਼ ਦੁਆਰ ਹੈ ਭਾਰਤ ਦਾ ਪ੍ਰਵੇਸ਼ ਦੁਆਰ ਅਤੇ ਜਿਸ ਕਰਕੇ ਇਥੇ ਸਾਡੇ ਵੱਖਰੇ ਵੱਖਰੇ ਖੇਤਰਾਂ ਤੋਂ ਆਏ ਹੋਏ ਲੋਕ ਵੱਸਦੇ ਹਨ ਅਤੇ ਜਿਸ ਕਰਕੇ ਇੱਥੇ ਇੱਕ ਸੱਭਿਆਚਾਰਕ ਸਾਂਝ ਵੀ ਬੜੀ ਹੈ ਅਤੇ ਸੱਭਿਆਚਾਰਕ ਭਿੰਨਤਾ ਵੀ ਹੈ ਅਤੇ ਇਹੀ ਸੱਭਿਆਚਾਰਿਕ ਭਿੰਨਤਾਂ ਜਿਹੜੀ ਹੈ ਸਾਡੀ ਲਾਈਫ ਸਾਡੇ ਜੀਵਨ ਦੇ ਵੱਖਰੇ ਵੱਖਰੇ ਖੇਤਰਾਂ ਦੇ ਵਿੱਚ ਹੈ ਜਿਵੇਂ ਖਾਣ ਪੀਣ ਦੇ ਵਿੱਚ ਸਾਡੇ ਰਹਿਣ ਸਹਿਣ ਦੇ ਵਿੱਚ ਸਾਡੇ ਨੱਚਣ ਗਾਉਣ ਦੇ ਵਿੱਚ ਸਾਡੀਆਂ ਜਿਹੜੀਆਂ ਜੀਵਨ ਦੇ ਜਿਹੜੇ ਸਾਡੀਆਂ ਸੁਭਾਅ ਹਨ ਉਹਨਾਂ ਦੇ ਵਿੱਚ ਖਾਣ ਪੀਣ ਦੇ ਵਿੱਚ ਕੀ ਹੈ ਕਿ ਜਿਹੜੇ ਪਿੰਡਾਂ ਦੇ ਵਿੱਚ ਰਹਿਣ ਵਾਲੇ ਲੋਕ ਹਨ ਉਹ ਸਾਦੇ ਖਾਣੇ ਪਸੰਦ ਕਰਦੇ ਹਨ ਪਰ ਸਾਡੇ ਸ਼ਹਿਰੀ ਖੇਤਰ ਵ ਵਿੱਚ ਵਸਣ ਵਾਲੇ ਲੋਕ ਜਿਹੜੇ ਜ਼ਿਆਦਾ ਮਸਾਲਿਆਂ ਦਾਰ ਜਾਂ ਜਿਵੇਂ ਪਾਸਤਾ ਪੀਜ਼ਾ ਇਸ ਤਰ੍ਹਾਂ ਦੇ ਖਾਣੇ ਜ਼ਿਆਦਾ ਪਸੰਦ ਕਰਦੇ ਹਨ ਅਤੇ ਇਸ ਤਰ੍ਹਾਂ ਲਾਈਫ ਸਟਾਈਲ ਦੀ ਜੇ ਅਸੀਂ ਗੱਲ ਕਰ ਲਈਏ ਕਿ ਜਿਹੜਾ ਸਾਡਾ ਰਹਿਣਾ ਸਹਿਣਾ ਹੈ ਬੜਾ ਸਾਦਾ ਹੈ ਪਿੰਡਾਂ ਦੇ ਵਿੱਚ ਪਰ ਸ਼ਹਿਰਾਂ ਦੇ ਵਿੱਚ ਕੀ ਹੈ ਕਿ ਇਸ ਦੇ ਵਿੱਚ ਰਹਿਣ ਸਹਿਣ ਦੇ ਵਿੱਚ ਸਾਡੇ ਪਹਿਰਾਵੇ ਦੇ ਵਿੱਚ ਬਹੁਤ ਜ਼ਿਆਦਾ ਬਦਲਾਅ ਆ ਗਿਆ ਹੈ ਔਰ ਇਸ ਤਰ੍ਹਾਂ ਹੀ ਡਾਂਸ ਸਾਡੇ ਨਾਚ ਦੀ ਲੋਕ ਨਾਚ ਦੀ ਗੱਲ ਕਰੀਏ ਤਾਂ ਲੋਕ ਨਾਥ ਨਾਚ ਦੇ ਵਿੱਚ ਵੀ ਜਿਵੇਂ ਗਿੱਧਾ ਭੰਗੜਾ ਲੋਕ ਕੁੜੀਆਂ ਬੋਲੀਆਂ ਪਾਉਂਦੀਆਂ ਮੁੰਡੇ ਭੰਗੜਾ ਪਾਉਂਦੇ ਤਾਂ ਉਹਦੇ ਵਿੱਚ ਵੀ ਉਹਨਾਂ ਦੇ ਆਪਣੇ ਭਾਵ ਛੁਪੇ ਹੁੰਦੇ ਹਨ ਪਰ ਸਾਡੇ ਪਿੰਡ ਸ਼ਹਿਰਾਂ ਦੇ ਵਿੱਚ ਕੀ ਹੈ ਕਿ ਲੋਕ ਇਹਨਾਂ ਨੂੰ ਛੱਡ ਕੇ ਸਾਰੇ ਆਪਣੇ ਭਾਵਾਂ ਨੂੰ ਫੋਨ ਤੱਕ ਡੀਪੈਂਡ ਹੋ ਗਏ ਹਨ ਫੋਨ ਤੱਕ ਹੀ ਸੀਮਿਤ ਹੋ ਗਏ ਹਨ ਕਿ ਹਰ ਚੀਜ਼ ਜਿਹੜੀ ਹੈ ਉਹ ਫੋਨ ਦੇ ਰਾਹੀਂ ਆਪਣੇ ਮਨ ਪਰਚਾਵਾ ਕਰਦੇ ਹਨ ਜਦਕਿ ਪਿੰਡਾਂ ਦੇ ਵਿੱਚ ਸਾਰੇ ਆਪਸ ਦੇ ਵਿੱਚ ਰਲ ਮਿਲ ਕੇ ਰਹਿੰਦੇ ਹਨ ਇੱਕ ਦੂਜੇ ਦੇ ਭਾਵ ਇੱਕ ਦੂਜੇ ਦੇ ਨਾਲ ਸਾਂਝੇ ਕਰਦੇ ਹਨ